ਆਈਫੋਨ ਫੋਨ ਇੱਕ ਵਧੀਆ ਫੋਨ ਹੈ ਬਹੁਤ ਵਧੀਆ ਬਰੈਂਡ ਹੈ ਇਹਦੀ ਕੈਮਰਾ ਕੁਆਲਿਟੀ ਬਹੁਤ ਹੀ ਵਧੀਆ ਹੈ ਅਤੇ ਇਹਦਾ ਸਕਿਓਰਟੀ ਫੀਚਰ ਸਭ ਤੋਂ ਵਧੀਆ ਹਨ ਅਤੇ ਇਹਦੀ ਡਿਸਪਲੇਅ ਬਹੁਤ ਜ਼ਿਆਦਾ ਸਮੂਥ ਚੱਲਦੀ ਹੈ ਇਹਦੇ ਸਪੀਕਰ ਆ ਜਿਹੜੇ ਉਹ ਬਹੁਤ ਵਧੀਆ ਅਵਾਜ਼ ਦਿੰਦੇ ਆ ਅਤੇ ਦੂਜੀ ਗੱਲ ਹੈ ਇਹ ਵਾਟਰ ਪਰੂਫ ਹੈ ਠੀਕ ਹੈ ਅਤੇ ਇਹਦਾ ਜਿਹੜਾ ਬੈਟਰੀ ਬੈਕਅੱਪ ਆ ਉਹ ਬਹੁਤ ਵਧਿਆ ਹੈ ਜਿਹੜੇ ਇਹਦੇ ਫੀਚਰ ਆ ਉਹ ਬਾਕੀ ਫੋਨਾਂ ਨਾਲੋਂ ਬਹੁਤ ਜ਼ਿਆਦਾ ਵਧੀਆ ਹਨ